ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੈਣ ਜੀ ਰੁਪਿੰਦਰ ਕੌਰ ਸਰਦਾਰਨੀ ਰੁਪਿੰਦਰ ਕੌਰ ਬੋਲ ਰਹੇ ਹੋ ਮੈਂ ਅਰਸ਼ਦੀਪ ਕੌਰ ਸਰਦਾਰਨੀ ਅਰਸ਼ਦੀਪ ਕੌਰ ਭੈਣ ਜੀ ਪਛਾਣ ਲਿਆ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਕਿਵੇਂ ਭੈਣ ਜੀ ਹਾਂਜੀ ਹਾਂਜੀ ਸਭ ਵਧੀਆ ਚੜ੍ਹਦੀ ਕਲਾ 'ਚ ਹੋਰ ਭੈਣ ਜੀ ਬਾਲ ਬੱਚੇ ਪੋਤਾ ਪੋਤੀ ਕਿਵੇਂ ਨੇ ਹਾਂਜੀ ਹਾਂਜੀ ਵਧੀਆ ਭੈਣ ਜੀ ਚੱਲੀ ਜਾਂਦਾ ਵਾਹਿਗੁਰੂ ਦੀ ਕ੍ਰਿਪਾ ਨਾਲ ਹੋਰ ਭੈਣ ਜੀ ਕੀ ਕਰਦੇ ਅੱਜ ਕੱਲ੍ਹ ਅੱਛਾ ਭੈਣ ਜੀ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਕਾਫ਼ੀ ਟੈਮ ਤੋਂ ਸੋਚ ਰਹੀ ਸੀ ਮੇਰੀ ਜਿਹੜੀ ਛੋਟੀ ਪੋਤੀ ਹੈ ਉਹ ਕੈਨੇੇਡਾ ਜਾਣ ਦੀ ਗੱਲ ਕਰ ਰਹੀ ਸੀ ਕਿ ਮੈਂ ਉਹਨੇ ਬ ਜ਼ਿੱਦ ਫੜੀ ਹੋਈ ਹੈ ਕਿ ਮੈਂ ਕੈਨੇਡਾ ਹੀ ਜਾਣਾ ਤਾਂ ਦੱਸੋ ਮੈਨੂੰ ਕੀ ਉਹਨੂੰ ਭੇਜਣਾ ਚਾਹੀਦਾ ਸਾਨੂੰ ਜਾਂ ਨਹੀਂ ਭੇਜਣਾ ਚਾਹੀਦਾ ਅੱਜ ਦੇ ਹਲਾਤਾਂ ਨੂੰ ਦੇਖ ਕੇ ਹਾਂਜੀ ਉਹ ਹਾਂਜੀ ਹਾਂਜੀ ਭੈਣ ਜੀ ਅਸੀਂ ਬੜਾ ਸਮਝਾਇਆ ਉਹਦੇ ਮੰਮੀ ਪਾਪਾ ਨੇ ਉਹਨੂੰ ਬਹੁਤ ਸਮਝਾਇਆ ਕਿ ਕੁਛ ਨਹੀਂ ਰੱਖਿਆ ਜੋ ਕਰਨਾ ਤੂੰ ਇੱਧਰ ਹੀ ਪੰਜਾਬ 'ਚ ਰਹਿ ਕੇ ਕਰ ਲੈ ਪਰ ਕਿੱਥੇ ਸਮਝਦੇ ਨੇ ਅੱਜ ਕੱਲ੍ਹ ਦੇ ਬੱਚੇ ਭੈਣ ਜੀ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਤਾਂ ਹੀ ਤਾਂ ਤੁਹਾਡੀ ਸਲਾਹ ਲੈਣੀ ਤੁਸੀਂ ਵੱਡੇ ਹੋ ਤਾਂ ਸੋਚਿਆ ਤੁਹਾਨੂੰ ਪਤਾ ਹੈ ਜ਼ਿਆਦਾ ਦੁਨੀਆਦਾਰੀ ਦਾ ਤਾਂ ਥੋੜ੍ਹਾ ਤੁਹਾਡੇ ਤੋਂ ਲੈ ਲੈਦੇ ਹਾਂ ਸਲਾਹ ਮਸ਼ਵਰਾ ਹਾਂਜੀ ਹਾਂਜੀ ਠੀਕ ਹੈ ਮੈਂ ਕਰਦੀ ਹਾਂ ਉਹਦੇ ਮੰਮੀ ਡੈਡੀ ਨਾਲ ਗੱਲ ਅਤੇ ਦੱਸਦੀ ਹਾਂ ਫਿਰ ਤੁਹਾਨੂੰ ਠੀਕ ਹੈ ਭੈਣ ਜੀ ਸਿਹਤਾਂ ਦਾ ਖਿਆਲ ਰੱਖਿਓ ਭੈਣ ਜੀ ਓਕੇ ਸਤਿ ਸ਼੍ਰੀ ਅਕਾਲ